ਮੈਂ ਫਲਿੱਪਕਾਰਟ ਤੋਂ ਇੱਕ ਪ੍ਰੋਡਕਟ ਆਡਰ ਕੀਤਾ ਸੀ ਜਿਹੜੀ ਕਿ ਇੱਕ ਓਆਈਐਲ ਬੋਟਲ ਸੀ ਉਹ ਕਿ ਬਜਾਜ ਕੰਪਨੀ ਦੀ ਸੀ ਉਹ ਪ੍ਰੋਡਕਟ ਮੈਂ ਪੱਚੀ ਤਰੀਕ ਨੂੰ ਆਡਰ ਕੀਤਾ ਸੀ ਬਟ ਉਹਦੀ ਖਰਾਬ ਪੈਕਜਿੰਗ ਦੀ ਵਜ੍ਹਾ ਹੋਣ ਕਾਰਨ ਉਹ ਬੋਟਲ ਅੰਦਰੋਂ ਡੈਮੇਜ਼ ਜਾਂ ਖਰਾਬ ਨਿਕਲੀ ਅਤੇ ਪੈਕਜਿੰਗ ਵੀ ਬਹੁਤ ਜ਼ਿਆਦਾ ਸੇਫ ਤਰੀਕੇ ਨਾਲ ਨਹੀਂ ਕੀਤੀ ਗਈ ਸੀ ਅਤੇ ਮੈਨੂੰ ਮੇਰਾ ਆਡਰ ਜਿਹੜਾ ਹੈਗਾ ਸਮੇਂ 'ਤੇ ਨਹੀਂ ਮਿਲ ਸਕਿਆ ਔ ਡਿਲੀਵਰੀ ਵੀ ਜਿਹੜੀ ਉਸਦੀ ਕਾਫੀ ਜ਼ਿਆਦਾ ਲੇਟ ਹੋਈ ਹੈ ਅਤੇ ਮੈਂ ਫਲਿੱਪਕਾਰਟ ਵਾਲਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰਾ ਆਰਡਰ ਬਦਲੀ ਜਾਂ ਰਿਫ਼ੰਡ ਕੀਤਾ ਜਾਵੇ ਅਤੇ ਮੇਰੀ ਬੇੇਨਤੀ ਨੂੰ ਸਵੀਕਾਰ ਕੀਤਾ ਜਾਵੇ